ਮੇਰੀ ਰਸੋਈ ਵਿੱਚ ਬਹੁਤ ਸਾਰੇ ਉਪਕਰਨ ਮੌਜੂਦ ਹਨ ਜਿਵੇਂ ਕਿ ਗ੍ਰਾਂਈਡਰ ਮਿਕਸਰ ਪੈਨ ਕੜਾਹੀ ਅਤੇ ਆਦੀ ਪਹਿਲਾਂ ਜਦੋਂ ਇਹ ਗੈਸ ਅਤੇ ਇਲੈਕਟ੍ਰੋਨਿਕ ਉਪਕਰਨ ਨਹੀਂ ਹੁੰਦੇ ਸਨ ਤਾਂ ਅਸੀਂ ਸਾਦੇ ਪਕਣ ਦੇ ਤਰੀਕੇ ਵਰਤਦੇ ਸਨ ਜਿਵੇਂ ਕਿ ਚੌਲ ਵਿੱਚ ਬਲਣੀ 'ਤੇ ਪਕਾਉਣਾ ਜਾਂ ਹੱਥ ਨਾਲ ਮਸਣਾ ਇਹ ਜ਼ਿਆਦਾ ਰਮਾ ਲੈਂਦੇ ਸੀ ਪਰ ਇਸ ਨਾਲ ਕਈ ਵਾਰੀ ਸਵਾਦ ਅਤੇ ਤਾਜ਼ਗੀ ਵੀ ਵਧਦੀ ਸੀ ਜਦੋਂ ਗੈਸ ਜਾਂ ਇਲੈਕਟ੍ਰੋਨਿਕ ਉਪਕਰਨ ਨਹੀਂ ਸਨ ਤਾਂ ਅਸੀਂ ਕਈ ਪਰੰਪਰਾਗਤ ਤਰੀਕੇ ਵਰਤਦੇ ਸਨ ਉਦਾਹਰਨ ਵਜੋਂ ਚੱਕੀ ਅਨਾਜ ਪੀਸਣ ਲਈ ਸਾਨੂੰ ਚੱਕੀ ਦੀ ਵਰਤੋਂ ਕਰਨੀ ਪੈਂਦੀ ਸੀ ਜੋ ਕਾਫ਼ੀ ਮਿਹਨਤ ਲੈਂਦੀ ਸੀ ਪਰ ਸੁਆਦ ਬਿਹਤਰ ਹੁੰਦਾ ਸੀ ਹੱਥ ਨਾਲ ਕੱਟਣਾ ਸਬਜ਼ੀਆਂ ਜਾਂ ਮਾਸ ਨੂੰ ਹੱਥ ਨਾਲ ਕੱਟਣਾ ਪੈਂਦਾ ਸੀ ਜੋ ਕਿ ਇੱਕ ਕਲਾ ਬਣ ਗਿਆ ਸੀ ਦਹਰਾਏ ਪਕਵਾਨਾਂ ਵਿੱਚ ਮਸਾਲਿਆਂ ਦੀ ਸੁੰਗਧ ਅਤੇ ਸੁਆਦ ਵਧਾਉਣ ਲਈ ਅਸੀਂ ਉਨ੍ਹਾਂ ਨੂੰ ਹੱਥ ਨਾਲ ਦੁਹਰਾਉਂਦੇ ਸਨ ਲੱਕੜ ਦੀ ਆਂਚ ਕਈ ਵਾਰੀ ਅਸੀਂ ਲੱਕੜ ਦੀਆਂ ਲੱਕੜੀਆਂ ਦੀ ਮਦਦ ਨਾਲ ਢੰ ਢੰਡਣ ਜਾਂ ਆਂਚ ਚਲਾਉਣ ਲਈ ਕੰਮ ਕਰਦੇ ਸਨ ਇਹ ਤਰੀਕੇ ਮਿਹਨਤ ਜਾਂ ਜ਼ਿਆਦਾ ਲੈਂਦੇ ਸਨ ਪਰ ਪਕਵਾਨ ਦੇ ਸੁਆਦ ਅਤੇ ਤਾਜ਼ਗੀ ਨੂੰ ਕਦੇ ਵੀ ਨਹੀਂ ਘਟਾਉਂਦੇ ਜਦੋਂ ਗੈਸ ਜਾਂ ਇਲੈਕਟ੍ਰੋਨਿਕ ਉਪਕਰਨ ਵੀ ਨਹੀਂ ਸੀ ਤਾਂ ਰਸੋਈ ਵਿੱਚ ਹੋਰ ਕਈ ਦਿਲਚਸਪ ਤਰੀਕੇ ਵੀ ਵਰਤੇ ਜਾਂਦੇ ਸਨ ਪਟਾ ਅਤੇ ਚੁੱਲ੍ਹਾ ਖਾਣਾ ਪਕਾਉਣ ਲਈ ਅਸੀਂ ਮਿੱਟੀ ਦੇ ਪਟੇ ਦਾ ਚੁੱਲ੍ਹੇ ਦੀ ਵਰਤੋਂ ਕਰਦੇ ਸੀ ਇਨ੍ਹਾਂ 'ਤੇ ਕਈ ਵੱਖ ਵੱਖ ਪਕਵਾਨ ਬਣਾਉਣ ਦਾ ਅਨੰਦ ਸੀ ਗਾਂਡਣ ਮਾਸ ਅਤੇ ਸਬਜ਼ੀਆਂ ਨੂੰ ਪਕਾਉਣ ਲਈ ਗਾਂਡਣ ਜਾਂ ਬਾਸਕਿਟ ਦੀ ਵਰਤੋਂ ਕੀਤੀ ਜਾਂਦੀ ਸੀ ਜਿਸ ਨਾਲ ਅਹਾਰ ਦਾ ਸੁਆਦ ਵੱਧਦਾ ਸੀ ਮੱਕੀ ਦੇ ਪੱਤੇ ਪਕਵਾਨਾਂ ਨੂੰ ਬੰਨਣ ਜਾਂ ਢੱਕਣ ਲਈ ਮੱਕੀ ਦੇ ਪੱਤੇ ਵਰਤੇ ਜਾਂਦੇ ਸਨ ਜਿਸ ਨਾਲ ਉਨ੍ਹਾਂ ਨੂੰ ਵਧੀਆ ਸੁਗੰਧ ਮਿਲਦੀ ਸੀ ਖਾਸ ਮਸਾਲੇ ਪਰੰਪਰਾਗਤ ਪਕਵਾਨ ਵਿੱਚ ਖਾਸ ਤਰੀਕੇ ਨਾਲ ਬਣਾਏ ਗਏ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਸੀ